ਹਾਂ ਮੈਂ ਪੰਜਾਬ ਵਿੱਚ ਵੱਖ ਵੱਖ ਭਾਈਚਾਰਿਆਂ ਅਤੇ ਸੱਭਿਆਚਾਰਾਂ ਵਿਚਕਾਰ ਸ਼ਾਂਤੀ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਭੂਮਿਕਾ ਦਾ ਵਰਣਨ ਕਰ ਸਕਦੀ ਹਾਂ ਮੈਂ ਇਨ੍ਹਾਂ ਭਾਈਚਾਰਿਆਂ ਅਤੇ ਸੱਭਿਆਚਾਰਾਂ ਵਿੱਚ ਸ਼ਾਂਤੀ ਅਤੇ ਸਮਝ ਨੂੰ ਉਤਸ਼ਾਹਿਤ ਕਰਨ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਇੱਕ ਬਹੁਤ ਵੱਡੀ ਭੂਮਿਕਾ ਸਮਝਦੀ ਹਾਂ ਜਿਵੇਂ ਵੱਖ ਵੱਖ ਭਾਈਚਾਰੇ ਅਤੇ ਸੱਭਿਆਚਾਰ ਹੈ ਉਨ੍ਹਾਂ ਦੀਆਂ ਸਾਰਿਆਂ ਦੀਆਂ ਆਪਣੀਆਂ ਆਪਣੀਆਂ ਕਲਾਵਾਂ ਹੁੰਦੀਆਂ ਹਨ ਆਪਣੀ ਆਪਣੀ ਸ਼ਿਲਪਕਾਰੀ ਹੈ ਉਨ੍ਹਾਂ ਕਲਾਵਾਂ ਦੇ ਨਾਲ ਜਿਵੇਂ ਕਿ ਗਿੱਧਾ ਭੰਗੜਾ ਗੱਤਕਾ ਝੂੰਮਰ ਆਦਿ ਇਨ੍ਹਾਂ ਦੇ ਨਾਲ ਉਹ ਸਮਾਜ ਦੇ ਵਿੱਚ ਆਪਣੇ ਆਪਣੇ ਧਰਮ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਭਾਈਚਾਰੇ ਨੂੰ ਪ੍ਰਗਟ ਕਰਦੇ ਹੈ ਅਤੇ ਉਨ੍ਹਾਂ ਦੀਆਂ ਅਲੱਗ ਅਲੱਗ ਸ਼ਿਲਪਕਾਰੀਆਂ ਹੁੰਦੀਆਂ ਹੈ ਜਿਸ ਦੇ ਨਾਲ ਜਿਵੇਂ ਕਿ ਮਿਊਜ਼ੀਅਮਸ ਦੇ ਵਿੱਚ ਬਹੁਤ ਕੁਛ ਸੰਭਾਲ ਕੇ ਰੱਖਿਆ ਹੁੰਦਾ ਹੈ ਜਿਸ ਤੋਂ ਸਾਨੂੰ ਕਿਸੇ ਕਲਾ ਕਿਸੇ ਧਰਮ ਅਤੇ ਕਿਸੇ ਸੱਭਿਆਚਾਰ ਦੇ ਬਾਰੇ ਪਤਾ ਲ ਚੱਲਦਾ ਹੈ ਅਤੇ ਉਨ੍ਹਾਂ ਦੇ ਵਿਚਕਾਰ ਕਿਸ ਤਰ੍ਹਾਂ ਦੀ ਸ਼ਾਂਤੀ ਆਪਸੀ ਸਮਝ ਕਿਸ ਤਰ੍ਹਾਂ ਦੀ ਸੀ ਉਹ ਸਾਨੂੰ ਸ਼ਿਲਪਕਾਰੀਆਂ ਤੋਂ ਪਤਾ ਚੱਲਦੀ ਹੈ ਅਤੇ ਕਲਾ ਹੈ ਜਿਹੜੀ ਉਹ ਕਿਸੇ ਵੀ ਸੱਭਿਆਚਾਰ ਦੇ ਵਿੱਚ ਕਿਸ ਤਰੀਕੇ ਦੇ ਲੋਕ ਹੈ ਉਨ੍ਹਾਂ ਦਾ ਕਿਆ ਕਿਆ ਕਲਚਰ ਕਿਆ ਉਨ੍ਹਾਂ ਦਾ ਸੱਭਿਆਚਾਰ ਹੈ ਉਸ ਨੂੰ ਪ੍ਰਗਟ ਕਰਦੀ ਹੈ